ਦੇਖਿਆ ਜਾਵੇ ਤਾਂ ਬਹੁਤ ਹੀ ਡਾਟਾ ਪਲਾਨ ਹਨ ਜਿਵੇਂ ਕਿ ਆਈਡੀਆ ਦਾ ਏਅਰਟੈਲ ਦਾ ਜੀਓ ਵੋਡਾਫੋਨ ਬੀਐਸਐਨਐਲ ਹੋਰ ਵੀ ਬਥੇਰੇ ਪ੍ਰਸਿੱਧ ਪਲੈਨ ਹਨ ਪਰ ਜੇ ਗੱਲ ਕੀਤੀ ਜਾਵੇ ਸਾਡੇ ਖੇਤਰ ਦੀ ਤਾਂ ਉੱਥੇ ਜ਼ਿਆਦਾਤਰ ਲੋਕ ਏਅਰਟੈਲ ਦੀ ਹੀ ਵਰਤੋਂ ਕਰਦੇ ਹਨ ਕਿਉਂਕਿ ਉਸ ਦਾ ਡਾਟਾ ਪਲੈਨ ਵੀ ਸਹੀ ਕੀਮਤ ਦਾ ਹੈ ਅਤੇ ਉਸਦੀ ਰੇਂਜ ਵੀ ਬਹੁਤ ਆਉਂਦੀ ਹੈ ਜੇ ਬਾਕੀ ਕੋਈ ਹੋਰ ਡਿਊਸ ਕ ਬਾਕੀ ਵੀ ਵਧੀਆ ਹਨ ਪਰ ਜੇ ਕੋਈ ਹੋਰ ਯੂਸ ਕਰੀਏ ਤਾਂ ਉਸ ਦੀ ਰੇਂਜ ਇੰਨੀ ਨਹੀਂ ਆਉਂਦੀ ਸਾਡੇ ਖਤਰ ਵਿੱਚ ਮੇਰੇ ਅਤੇ ਮੇਰੇ ਪਰਿਵਾਰ ਨੇ ਏਅਰਟੈਲ ਹੀ ਚੁਣੀ ਹੋਈ ਹੈ ਉਸ ਦਾ ਡਾਟਾ ਪੈਕ ਵੀ ਸਹੀ ਹੈ ਅਤੇ ਮਿਲਦਾ ਵੀ ਜ਼ਿਆਦਾ ਹੈ ਬਾਕੀ ਡਾਟਾ ਪਲੈਨ ਨਾਲੋਂ ਕਿਉਂਕਿ ਮੈਨੂੰ ਬਹੁਤ ਜ਼ਰੂਰਤ ਹੁੰਦੀ ਹੈ ਡਾਟਾ ਪਲਾਨ ਦੀ ਅਤੇ ਉਸ ਦੀ ਬਾਕੀ ਡਾਟਾ ਪਲਾਨ ਦੀ ਪ੍ਰੋਸੈਸਿੰਗ ਚਲਦੀ ਹੈ ਅਤੇ ਇਸ ਇਹ ਨਾਲ ਦੀ ਨਾਲ ਹੀ ਅਪਲੋਡ ਕਰ ਦਿੰਦੀ ਹੈ ਜੀ ਧੰਨਵਾਦ